ਅੱਜ ਮੈਂ ਔਨਲਾਈਨ ਕੱਪੜਾ ਮੰਗਵਾਇਆ ਪਹਿਲਾਂ ਕਦੀ ਮੰਗਵਾਇਆ ਹੀ ਨਹੀਂ ਸੀਗਾ ਮੈਨੂੰ ਬਾਹਲਾ ਸ਼ੌਕ ਨਹੀਂ ਆ ਮਗਰ ਫਿਰ ਵੀ ਮੈਂ ਕਿਹਾ ਚੱਲ ਦੇਖਣ ਨੂੰ ਸੋਹਣਾ ਲੱਗ ਰਿਹਾ ਮੈਂ ਮੰਗਵਾ ਲਿਆ ਮੰਗਵਾ ਕੇ ਦੇਖਿਆ ਹੱਥ ਲਾਇਆ ਸਵਾਹ ਦੀ ਖੇਹ ਨਿਕਲਿਆ ਕੱਪੜਾ ਕੋਈ ਜਿਹੋ ਜਿਹਾ ਉਹ ਫੋੋਟੋ 'ਚ ਰੰਗ ਦਿਖਾਉਂਦੇ ਸੀ ਉਹ ਜਿਹਾ ਤਾਂ ਰੰਗ ਹੀ ਨਹੀਂ ਆ ਐਨਾ ਫਿੱਕਾ ਫਿੱਕਾ ਰੰਗ ਆ ਆਹ ਕੋਈ ਰੰਗ ਹੁੰਦਾ ਹੈ ਕਿਸੇ ਦੇ ਉੱਤੇ ਨਾ ਜਚੇ ਫਿਰ ਮੈਂ ਕਿਹਾ ਚੱਲ ਹੁਣ ਜਿਹੜੀ ਚੀਜ਼ ਆ ਗਈ ਆ ਕੀ ਕਰਨੀ ਆ ਸੁੱਟਣੀ ਕਾਹਤੇ ਮੋੜਨੀ ਕਾਹਤੇ ਹੈ ਚੰਗਾ ਜਿਹਾ ਨਹੀਂ ਲੱਗਦਾ ਮੈਂ ਫਿਰ ਧੋ ਕੇ ਬੰਦਾ ਪਾ ਹੀ ਲੈਂਦਾ ਜੇ ਮੈਂ ਧੋ ਤੀ ਧੋਣ 'ਤੇ ਸਾਰਾ ਦਾ ਸਾਰਾ ਰੰਗ ਨਿਕਲ ਗਿਆ ਇੱਕ ਪੱਧਰ ਹੋਰ ਭੈੜਾ ਹੋ ਗਿਆ ਅੜੀਏ ਨਾਲੇ ਤਾਂ ਸੁੰਗੜ ਕੇ ਛੋਟਾ ਜਿਹਾ ਹੀ ਹੋ ਗਿਆ ਇਹ ਤਾਂ ਮੇਰੇ ਨਾਪ ਦਾ ਵੀ ਨਹੀਂ ਆ ਘੱਟੋਂ ਘੱਟ ਚੀਜ਼ ਚੱਜ ਦੀ ਤਾਂ ਹੋਵੇ ਮੇਰੇ ਨਾਪ ਦੀ ਹੁੰਦੀ ਮੈਂ ਪਾ ਲੈਂਦੀ ਹੁਣ ਦੱਸ ਇਹਨੂੰ ਕਿਹੜੇ ਮੱਥੇ ਲਾਵਾਂ ਨਾ ਇਹ ਰੇਟ ਦੇਖਦਾ ਜਿਹੜੇ ਰੇਟ ਨੂੰ ਇਹਨਾਂ ਨੇ ਦੱਸਿਆ ਸੀ ਉੱਨੇ ਰੇਟ ਨੂੰ ਤਾਂ ਬਾਈ ਮੈਂ ਦੋ ਸੂਟ ਲੈ ਲਵਾਂ ਆਹ ਇੱਕ ਕੁੜਤੀ ਮੇਰੇ ਮੱਥੇ ਪਈ ਆ ਨਾ ਮੈਂ ਇਹਨੂੰ ਪਾਉਣ ਯੋਗੀ ਨਾ ਮੈਂ ਕਿਸੇ ਨੂੰ ਦੇ ਸਕਦੀ ਹਾਂ ਦੱਸ ਮੇਰਾ ਤਾਂ ਬਹੁਤ ਬੁਰਾ ਐਕਸਪੀਰੀਅੰਸ਼ ਰਿਹਾ ਵੀ ਮੈਂ ਨਹੀਂ ਮੁੜ ਕੇ ਤੋਂ ਖਰੀਦਦੀ ਔਨਲਾਈਨ ਕੰਨ ਹੱਥ ਲੱਗੇ ਬਾਈ ਬਾਬਾ